ਮੇਰੇ ਲਈ ਚਿੱਤਰਕਾਰੀ ਦਾ ਸਭ ਤੋਂ ਚੁਣੌਤੀਪੂਰਨ ਪਹਿਲੂ ਇੱਕ ਤਾਂ ਇਹ ਹੈ ਕਿ ਜਿਹੜਾ ਕਲਪਨਾ ਦੇ ਅੰਦਰ ਚਿਤਵਿਆ ਹੋਇਆ ਚਿੱਤਰ ਹੁੰਦਾ ਉਹਨੂੰ ਖਾਲੀ ਕਾਗਜ਼ ਉੱਤੇ ਕਿਵੇਂ ਉਤਾਰਨਾ ਉਹਦਾ ਦ੍ਰਿਸ਼ਟੀਕੋਣ ਉਹਦੇ ਉਹਦੇ ਵੱਖ ਵੱਖ ਪੱਖ ਨਜ਼ਰੀਆ ਬਿਲਕੁਲ ਸਹੀ ਤਰੀਕੇ ਨਾਲ ਕਿੱਦਾਂ ਰੱਖਣਾ ਕਿ ਉਹ ਟੇਡਾ ਮੇਡਾ ਨਾ ਹੋਵੇ ਕੋਈ ਆਕਾਰ ਛੋਟੇ ਵੱਡੇ ਨਾ ਰਹਿ ਜਾਣ ਇਹ ਦੂਜਾ ਜਿਹੜਾ ਹੈ ਅੰਗ ਬਣਾਉਣੇ ਖਾਸ ਕਰ ਹੱਥ ਪੈਰ ਬਾਹਾਂ ਦੀ ਲੰਬਾਈ ਉਂਗਲੀਆਂ ਦੀਆਂ ਗੱਠਾਂ ਇਹ ਬਣਾਉਣਾ ਮੈਨੂੰ ਔਖਾ ਲੱਗਦਾ ਇਹਨੂੰ ਦੂਰ ਕਰਨ ਲਈ ਮੈਂ ਜ਼ਿਆਦਾਤਰ ਵਾਰ ਵਾਰ ਮਿਹਨਤ ਕਰਦੀ ਹਾਂ ਜਾਂ ਫਿਰ ਸਕੁਏਅਰ ਗਰਿੱਡ ਦੀ ਵਰਤੋਂ ਕਰਦੀ ਹਾਂ ਲਾਈਨਾਂ ਮਾਰ ਕੇ ਸਹੀ ਐਂਗਲਸ ਨਾਲ ਤਾਂ ਕਿ ਕਾਗਜ਼ ਉੱਤੇ ਬਿਲਕੁਲ ਸਹੀ ਤਰੀਕੇ ਨਾਲ ਜਿਹੜੀ ਚੀਜ਼ ਜਿੱਥੇ ਆਉਣੀ ਆ ਉੱਥੇ ਉੱਥੇ ਉਵੇਂ ਉਵੇਂ ਉੱਤਰ ਸਕੇ ਅਤੇ ਬਾਕੀ ਹੱਥਾਂ ਨੂੰ ਬਣਾਉਣ ਦੀ ਵੱਖ ਵੱਖ ਦ੍ਰਿਸ਼ਟੀਕੋਣ ਤੋਂ ਹੱਥ ਕਿੱਦਾਂ ਲੱਗਦੇ ਹਨ ਕਿੱਦਾਂ ਮੁੜੇ ਹੋਏ ਹੱਥ ਖੁੱਲ੍ਹੇ ਹੱਥ ਇਹ ਸਭ ਦਾ ਮੈਂ ਅਭਿਆਸ ਕਰਦੀ ਹਾਂ ਇਹਦੇ ਨਾਲ ਅੱਗੇ ਨਾਲੋਂ ਜਦੋਂ ਵੀ ਤੁਸੀਂ ਬਣਾਉਂਦੇ ਹੋ ਤੁਹਾਡੇ ਹੱਥਾਂ ਦੇ ਮਤਲਬ ਜਲਦੀ ਬਣਨਾ ਸ਼ੁਰੂ ਹੋ ਜਾਂਦਾ ਸੌਖਾ ਹੋ ਜਾਂਦਾ ਅਤੇ ਅਭਿਆਸ ਕਰਨ ਲਈ ਮੈਂ ਜ਼ਿਆਦਾਤਰ ਪਿਨਟਰਸਟ ਤੋਂ ਜਿਹੜੀਆਂ ਫੋਟੋਆਂ ਹਨ ਉਹ ਵਰਤਦੀ ਹਾਂ ਜਾਂ ਫਿਰ ਅਸਲੀ ਜੀਵਨ ਤੋਂ ਕੋਈ ਬੈਠਾ ਹੈ ਉਹਨੂੰ ਦੇਖ ਕੇ ਕਿੱਦਾਂ ਚਿੱਤਰ ਨੂੰ ਘੜਨਾ ਹੈ ਉਹਦੀਆਂ ਅੱਖਾਂ ਅਤੇ ਹੱਥ ਮੇਲ ਖਾ ਰਹੇ ਹਨ ਅਤੇ ਜਿਹੜੀ ਉਹਨਾਂ ਦੀ ਪੁਜ਼ੀਸ਼ਨ ਹੈ ਉਹ ਸਹੀ ਹੈ ਇਹ ਚੀਜ਼ ਨੂੰ ਮੈਂ ਧਿਆਨ 'ਚ ਰੱਖ ਕੇ ਜਦੋਂ ਅਭਿਆਸ ਕਰਦੀ ਹਾਂ ਤਾਂ ਅੱਗੇ ਨਾਲੋਂ ਬਿਹਤਰ ਮੇਰੇ ਚਿੱਤਰ ਹੋ ਜਾਂਦੇ ਹਨ